ਮੈਂ ਆਪਣੇ ਲਾਈਫ਼ ਵਿੱਚ ਹਮੇਸ਼ਾ ਹੀ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਅਤੇ ਜਾਂ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਨੂੰ ਐਜ ਅ ਗਿਫ਼ਟ ਦੇਣਾ ਜ਼ਿਆਦਾਤਰ ਤਰਜੀਹ ਦਿੰਦਾ ਆਹ ਹੁਣੀ ਕੁਛ ਸਮਾਂ ਪਹਿਲਾਂ ਮੈਂ ਆਪਣੇ ਇੱਕ ਫਰੈਂਡ ਨੂੰ ਆਪਣੇ ਹੱਥੀਂ ਇੱਕ ਪੇਂਟਿੰਗ ਬਣਾ ਕੇ ਦਿੱਤੀ ਇੱਕ ਆਪਣੇ ਹੱਥੀਂ ਪੇਂਟਿੰਗ ਬਣਾਉਣ 'ਚ ਅਤੇ ਕੋਈ ਅਲੱਗ ਤੋਂ ਗਿਫ਼ਟ ਲੈਣਾ ਜਿਵੇਂ ਫੋਟੋ ਫਰੇਮ ਬਣਾ ਲਿਆ ਜਾਂ ਵਗੈਰਾ ਵਗੈਰਾ ਇਹਨਾਂ ਦੋਵਾਂ ਚੀਜ਼ਾਂ 'ਚ ਫੋ ਬਹੁਤ ਫ਼ਰਕ ਹੁੰਦਾ ਫ਼ਰਕ ਕੀ ਹੁੰਦਾ ਉਹ ਮੈਂ ਦੱਸਦਾ ਪਹਿਲਾ ਫ਼ਰਕ ਤਾਂ ਫੋਟੋ ਫਰੇਮ ਕਰਵਾ ਕੇ ਦੇਵਾਂ ਤਾਂ ਉਹਦੇ 'ਚ ਫੀਲਿੰਗਸ ਨਹੀਂ ਆਉਣੀਆਂ ਉਹ ਤਾਂ ਜਸਟ ਐਜ ਅ ਫੋਟੋ ਖਿੱਚੀ ਪ੍ਰਿੰਟ ਕਢਵਾ ਕੇ ਦਿੱਤਾ ਬਟ ਅਗਰ ਮੈਂ ਆਪਣੇ ਹੱਥੀਂ ਕੋਈ ਚੀਜ਼ ਬਣਾਉਂਗਾ ਉਹਨੂੰ ਗਿਫ਼ਟ ਕਰੂੰਗਾ ਉਹਦੇ 'ਚ ਮੈਂ ਆਪਣੀਆਂ ਸਾਰੀਆਂ ਫੀਲਿੰਗਸ ਐਡ ਕਰੂੰਗਾ ਅਤੇ ਜੋ ਮੈਂ ਕਹਿਣਾ ਚਾਹੁੰਦਾ ਆਪਣੇ ਆਰਟ ਦੁਆਰਾ ਮੈਂ ਕਹੂੰਗਾ ਇਹਨਾਂ ਦੋਨਾਂ ਚੀਜ਼ਾਂ 'ਚ ਬਹੁਤ ਫ਼ਰਕ ਹੁੰਦਾ ਹੁਣ ਪਿਛਲੇ ਦੋ ਕੁ ਦੋ ਕੁ ਮਹੀਨੇ ਪਹਿਲਾਂ ਮੇਰੇ ਇੱਕ ਮੇਰੇ ਇੱਕ ਫਰੈਂਡ ਦਾ ਬਰਥਡੇ ਸੀਗਾ ਦੈੱਨ ਆਈ ਥੋਟ ਕਿ ਮੈਂ ਆਪਣੇ ਹੱਥ ਨਾਲ ਉਹਦੀ ਪੇਂਟਿੰਗ ਬਣਾਊਂਗਾ ਮੈਨੂੰ ਪੇਂਟਿੰਗ ਦਾ ਸਕੈਚਿੰਗ ਦਾ ਵੀ ਬਹੁਤ ਸ਼ੌਕ ਹੈ ਮੈਂ ਤਿੰਨ ਚਾਰ ਦਿਨ ਲਾ ਕੇ ਇੱਕ ਬਹੁਤ ਖੂਬਸੂਰਤ ਪੇਂਟਿੰਗ ਬਣਾਈ ਔਰ ਉਸ ਪੇਂਟਿੰਗ ਦਾ ਮੁੱਲ ਪਤਾ ਕਿਵੇਂ ਪਿਆ ਜਦੋਂ ਮੈਂ ਉਹ ਪੇਂਟਿੰਗ ਉਹਨੂੰ ਗਿਫ਼ਟ ਕੀਤੀ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਆ ਗਿਆ ਬਿਕੋਜ ਮੈਂ ਆਪਣੀ ਪੇਂਟਿੰਗ 'ਚ ਆਪਣੇ ਸਕੈਚ 'ਚ ਉਹਦੇ ਬਚਪਨ ਦਾ ਜੋ ਸੀਗਾ ਉਹਦਾ ਰੂਪ ਉਹ ਦਰਸਾਇਆ ਜਿਵੇਂ ਜਿਵੇਂ ਮੈਂ ਉਹਦੇ ਨਾਲ ਟਾਈਮ ਸਪੈਂਡ ਕੀਤਾ ਉਹ ਉਹ ਚਿੱਤਰ ਬਣਾ ਕੇ ਉਹਨੂੰ ਦਿੱਤੇ ਸੋ ਮੇਰਾ ਐਕਸਪੀਰੀਐਂਸ ਇਹ ਕਹਿੰਦਾ ਕਿ ਹੱਥ ਨਾਲ ਬਣਾਈਆਂ ਚਿੱਤਰਕਾਰੀਆਂ ਜ਼ਿਆਦਾ ਇੰਪੈਕਟਫੁਲ ਹੁੰਦੀਆਂ ਨੇ